ਭਾਰਤ ਵਿੱਚ ਵੈਸੇ ਤਾਂ ਕਈ ਤਿਉਹਾਰ ਮਨਾਏ ਜਾਂਦੇ ਹਨ ਜੇ ਅਸੀਂ ਮਹੱਤਵਪੂਰਨ ਤਿਉਹਾਰਾਂ ਦੀ ਗੱਲ ਕਰੀਏ ਤਾਂ ਦੀਵਾਲੀ ਹੋਲੀ ਦੁਸਹਿਰਾ ਇਸ ਵਿੱਚ ਮੁੱਖ ਹਨ ਦੀਵਾਲੀ ਨੂੰ ਲੋਕ ਦੀਵੇ ਅਤੇ ਬੱਤੀਆਂ ਬਾਲਦੇ ਹਨ ਅਤੇ ਲਕਸ਼ਮੀ ਜੀ ਦੀ ਪੂਜਾ ਕਰਦੇ ਹਨ ਇਸ ਦਿਨ ਬੱਚੇ ਪਟਾਕੇ ਚਲਾ ਕੇ ਇਸ ਤਿਉਹਾਰ ਦਾ ਆਨੰਦ ਮਾਣਦੇ ਹਨ ਇਸ ਤੋਂ ਇਲਾਵਾ ਹੋਲੀ ਵੀ ਇੱਕ ਮਹੱਤਵਪੂਰਨ ਤਿਉਹਾਰ ਹੈ ਇਸ ਦਿਨ ਬੱਚੇ ਇੱਕ ਦੂਜੇ ਨੂੰ ਰੰਗ ਲਗਾ ਕੇ ਇਹ ਤਿਉਹਾਰ ਮਨਾਉਂਦੇ ਹਨ ਅਤੇ ਮਿਠਾਈਆਂ ਵੀ ਖਾਂਦੇ ਹਨ ਇਸ ਤੋਂ ਇਲਾਵਾ ਦੁਸਹਿਰਾ ਵੀ ਇੱਕ ਪ੍ਰਮੁੱਖ ਭਾਰਤ ਦਾ ਪ੍ਰਮੁੱਖ ਤਿਉਹਾਰ ਹੈ